ਮੈਂ ਬਾਗਬਾਨੀ ਬਹੁਤ ਜ਼ਿਆਦਾ ਸ਼ੌਂਕਿਆ ਤੌਰ 'ਤੇ ਪਸੰਦ ਕਰਦਾ ਕਿਉਂਕਿ ਮੈਨੂੰ ਸ਼ੁਰੂ ਤੋਂ ਹੀ ਪੌਦੇ ਆਪਣੀ ਬਾ ਘਰ ਦੇ ਬਾਹਰ ਜਿੱਦਾਂ ਕਿਆਰੀ ਬਣਾ ਕੇ ਬਾਗਬਾਨੀ ਲਾਉਣ ਦਾ ਬਹੁਤ ਹੀ ਜ਼ਿਆਦਾ ਸ਼ੌਂਕ ਹੈ ਔਰ ਮੈਂ ਕਈ ਤਰ ਕਈ ਥਾਵਾਂ ਤੋਂ ਅਲੱਗ ਅਲੱਗ ਤਰ੍ਹਾਂ ਦੇ ਪੌਦੇ ਬੂਟੇ ਫੁੱਲਾਂ ਦੇ ਬੂਟੇ ਹੋ ਗਏ ਅਲੱਗ ਅਲੱਗ ਤਰ੍ਹਾਂ ਦੇ ਰੁੱਖ ਇਹਨਾਂ ਨੂੰ ਲਗਾਉਣ ਦਾ ਸ਼ੌਂਕ ਰੱਖਦਾ ਹਾਂ ਔਰ ਮੈਂ ਕਈ ਵਾਰ ਦੇਖਿਆ ਹੈ ਮੈਂ ਜਦੋਂ ਕਿਤੇ ਵੀ ਜਾਂਦਾ ਮੈਨੂੰ ਕਿਸੇ ਦੇ ਘਰ ਦੇ ਬਾਹਰ ਦੇਖਣ ਨੂੰ ਮਿਲਦਾ ਹੈ ਕਿ ਹਏ ਉਹ ਦੇਖੋ ਕਿੰਨੇ ਸੋਹਣੇ ਕਿਆਰੀ ਬਣਾਈ ਏ ਬਾਗਬਾਨੀ ਬਣਾਈ ਹੈ ਔਰ ਕਿੰਨੇ ਸੋਹਣੇ ਉਹਦੇ ਡਿਜ਼ਾਇਨ ਵਾਲੇ ਬੂਟੇ ਔਰ ਫਲਾਵਰ ਕਿੱਦਾਂ ਸਜਾਏ ਹੋਏ ਹੈ ਪਰ ਮੈਂ ਕਈ ਯੂਨਿਵੇਰਸਿਟੀ 'ਚ ਵੀ ਦੇਖਦਾ ਕਈਆਂ ਨਾ ਉਹਨਾਂ ਨੂੰ ਨਾ ਕਈ ਵਾਰ ਦੇਖਣ ਨੂੰ ਮਿਲਦਾ ਹੈ ਕਿ ਉਹਨਾਂ ਨੇ ਯੂਨੀਵਰਸਿਟੀ ਦਾ ਨਾਮ ਪੌਦਦਿਆਂ ਦੇ ਥਰੂ ਲਿਖਿਆ ਹੁੰਦਾ ਹੈ ਵਿੱਚ ਪੌਦੇ ਔਰ ਕੱਟਿੰਗ ਕਰਕੇ ਮੈਂ ਕਈ ਵਾਰ ਸੋਚਦਾਂ ਕਿ ਕਿੱਦਾਂ ਕਰ ਲੈਂਦੇ ਹਨ ਉਸੇ ਸੋਚ ਨੂੰ ਮੈਂ ਦੇਖਦੇ ਹੋਏ ਨਾ ਕਿ ਮੈਨੂੰ ਸ਼ੌਂਕ ਪੈ ਗਿਆ ਕਿ ਮੈਂ ਆਪਣੇ ਘਰ ਦੇ ਬਾਹਰ ਹੁਣ ਮੈਂ ਆਪਣੇ ਘਰ ਦੇ ਬਾਹਰ ਪਤਾ ਨਹੀਂ ਕਿੰਨੇ ਕਈ ਤਰ੍ਹਾਂ ਦੇ ਫੁੱਲ ਬੂਟੇ ਲਗਾਏ ਹੈ ਔਰ ਮੈਂ ਉਹਨਾਂ ਨੂੰ ਰੋਜ਼ ਹੀ ਬੂਟਿਆਂ ਨੂੰ ਪਾਣੀ ਦੇਣਾ ਔਰ ਇੱਕ ਸਾਰ ਇੱਕ ਬਿਲਕੁਲ ਇੱਕ ਤਰ੍ਹਾਂ ਉਹਨਾਂ ਨੂੰ ਰੱਖਣਾ ਇਹ ਮੈਂ ਕਈ ਵਾਰ ਦੇਖਦਾ ਹੁੰਦਾ ਕਿ ਇਹ ਵੀ ਆਪਣੇ ਵਰਗੇ ਹੀ ਹੈ ਔਰ ਕਿ ਕਿੰਨੀ ਸੁਗੰਧ ਮਿਲਦੀ ਆ ਇਹਨਾ ਤੋਂ ਹੁਣ ਮੈਂ ਕਈ ਪਲਾਂਟ ਲਗਾਏ ਕਈ ਰੁੱਖ ਲਗਾਏ ਜੈਸੇ ਆਪਣਾ ਕਹਿ ਸਕਦਾ ਪਾਮ ਦਾ ਰੁੱਖ ਹੋ ਗਿਆ ਔਰ ਅਮਰੂਦ ਦਾ ਹੋ ਗਿਆ ਸ਼ਹਿਤੂਤ ਦਾ ਹੋ ਗਿਆ ਅੰਬ ਦਾ ਹੋ ਗਿਆ ਔਰ ਜਾਮਣ ਹੋ ਗਿਆ ਕਈ ਮੈਂ ਪੇੜ ਲਗਾਏ ਹੈ ਔਰ ਇਹ ਇੱਕ ਤਾਂ ਪੇੜਾਂ ਤੋਂ ਆਪਾਂ ਕਹਿ ਸਕਦੇ ਹਾਂ ਇੱਕ ਤਾਂ ਛਾਂ ਮਿਲਦੀ ਆ ਆਕਸੀਜਨ ਮਿਲਦੀ ਹੈ ਔਰ ਕੁਛ ਫਰੂਟ ਔਰ ਜਿੱਦਾਂ ਜਾਮਨ ਸ਼ੂਗਰ ਦਾ ਬਹੁਤ ਜ਼ਿਆਦਾ ਇਲਾਜ ਹੈ ਮੈਂਗੋ ਮਿਲਦੇ ਅਨ ਔਰ ਕਈ ਚੀਜ਼ਾਂ ਰਬਰ ਪਲਾਂਟ ਹੋ ਗਿਆ ਇਹ ਕਾਫੀ ਕੁਝ ਦੇਖ ਮਤਲ ਕੇ ਹੈਗਾ ਸਫੈਦਾ ਜਿਹੜਾ ਹੈਗਾ ਇਹ ਇਹ ਦੇਖ ਲਓ ਸਫੈਦਾ ਆਪਾਂ ਨੂੰ ਲੱਕੜ ਮਿਲਦੀ ਹੈ ਔਰ ਲੋਕ ਇਹਨੂੰ ਲੱਕੜ ਦੀ ਤਰ੍ਹਾਂ ਯੂਜ ਕਰਦੇ ਲੇਕਿਨ ਮੈਂ ਲੱਕੜ ਨਹੀਂ ਯੂਜ ਕਰਦਾ ਮੈਂ ਇਹਨੂੰ ਆਪਣੇ ਜਿੱਦਾਂ ਇਨਸਾਨ ਦੇ ਰੂਪ ਦੇ ਵਿੱਚ ਇਹਨੂੰ ਹਮੇਸ਼ਾ ਆਪਣੇ ਕੋਲ ਯੂਜ ਕਰਦਾ ਕਿ ਮੈਂ ਵੀ ਜਿੱਦਾਂ ਇਹਨਾਂ ਚ ਵੀ ਜਾਨ ਹੈਗੀ ਜਦੋਂ ਸਾਡੇ 'ਚ ਜਾਣ ਹੈਗੀ ਇਹਨਾਂ ਨੂੰ ਕੋਈ ਤੋੜਦਾ ਇਹਨਾਂ ਨੂੰ ਕਿੰਨਾ ਦੁੱਖ ਹੋਊਗਾ ਮੈਂ ਇੰਨਾ ਸ਼ੋਂਕ ਹੈ ਬਾਗਬਾਨੀ ਦਾ ਹੈਗਾ ਨਾ ਮੈਨੂੰ ਸ਼ੌਂਕ ਕਿ ਮੈਂ ਤਾਂ ਰੋਜ਼ ਆਪਣੇ ਘਰ ਨਵੇਂ ਸੇ ਨਵੇਂ ਫੁੱਲ ਲਗਾ ਕੇ ਰੱਖਨਾ ਔਰ ਰੋਜ਼ ਤਿੰਨ ਟੈਮ ਉਹਨਾਂ ਨੂੰ ਪਾਣੀ ਦੇਣਾ ਔਰ ਜਦੋਂ ਮੈਂ ਆਫਿਸ ਤੋਂ ਆਉਣਾ ਪਹਿਲਾਂ ਉਹਨਾਂ ਨੂੰ ਦੇਖਣਾ ਬਾਅਦ ਵਿੱਚ ਘਰ ਵਿੱਚ ਜਾਣਾ ਕਿ ਕਿੱਦਾਂ ਦੇ ਇਹ ਕਿਸੇ ਨੂੰ ਕੁਛ ਹੋਇਆ ਤਾਂ ਨਹੀਂ ਕੀ ਫੁੱਲ ਬਿਲਕੁਲ ਸਹੀ ਹੈ ਇਹ ਸਾਰਾ ਕੁਝ ਦੇਖਣ ਨੂੰ ਮਿਲਦਾ ਹੈ ਮੈਂ ਕਈ ਵਾਰ ਦੇਖਣ ਨੂੰ ਮਿਲਦਾ ਹੈ ਕਿ ਲੋਕ ਫੁੱਲ ਤੋੜਦੇ ਆ ਔਰ ਜ਼ਮੀਨ ਤੇ ਸੁੱਟ ਦਿੰਦੇ ਹੈ ਔਰ ਮੈਂ ਉਹਨਾਂ ਨੂੰ ਕਈ ਵਾਰੀ ਡਾਂਟ ਦਾ ਵੀ ਹਾਂ ਕਿ ਇਹ ਵੀ ਆਪਣੀ ਇੱਕ ਜੀਵ ਐ ਕੀ ਉਹਨਾਂ ਨੂੰ ਦੇਖ ਕੇ ਤੁਸੀਂ ਇਹ ਤੋੜ ਕੇ ਸੁੱਟ ਦਿੱਤਾ ਮੰਦਰ ਚੜਾਉਨਾ ਤਾਂ ਸੁੱਟ ਦਿੱਤਾ ਪਰ ਨਹੀਂ ਇਹਨਾਂ ਨੂੰ ਤੋੜੋ ਨਾ ਮਹਿਸੂਸ ਕਰੋ ਕਿ ਇਹ ਵੀ ਇੱਕ ਇਨਸਾਨ ਦੀ ਤਰ੍ਹਾਂ ਹੈ ਅਤੇ ਉਹਨਾਂ ਨੂੰ ਪ੍ਰੇਰਣਾ ਇਹ ਮਿਲਦੀ ਹੈ ਕਿ ਆਪਣਾ ਜੇ ਪੌਦੇ ਨਾ ਹੋਣ ਪੇੜ ਨਾ ਹੋਵੇ ਤਾਂ ਸਾਡੇ ਕੋਲ ਆਕਸੀਜਨ ਨਹੀਂ ਹੋਊਗੀ ਔਰ ਆਉਣ ਵਾਲਾ ਸਮਾਂ ਬਿਨ੍ਹਾਂ ਆਕਸੀਜਨ ਤੋਂ ਬਹੁਤ ਮਤਲ ਕਿ ਕਢਣਾ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਐਵੇਂ ਥੋੜ੍ਹਾ ਸਾਰੇ ਕਹਿੰਦੇ ਹੈ ਸਰਕਾਰ ਵੀ ਕਹਿੰਦੀ ਹੈ ਕਈ ਵੀ ਤੁਹਾਨੂੰ ਅੱਜ ਕਲ੍ਹ ਨਯੂਜ਼ ਇੱਕ ਹੀ ਹੈ ਰੁੱਖ ਲਗਾਓ ਔਰ ਦੇਖਣ ਨੂੰ ਮਿਲਦਾ ਹੈ ਕਿ ਲੋਕ ਕੱਟੀ ਜਾ ਰਹੇ ਹੈ ਔਰ ਮੈਂ ਇਸ ਹੱਕ 'ਚ ਨਹੀਂ ਹੈਗਾ ਮੈਂ ਇਹ ਹੀ ਚਾਹੂੰਗਾ ਕਿ ਸਰਕਾਰ ਨੂੰ ਵੀ ਸਭ ਤੋਂ ਪਹਿਲਾਂ ਇਸ ਚੀਜ਼ ਨੂੰ ਪਰੋਸਾਹਿਤ ਕਰਨਾ ਚਾਹੀਦਾ ਹੈ ਸਰਕਾਰ ਨੂੰ ਵੀ ਸਭ ਤੋਂ ਪਹਿਲਾਂ ਇਸ ਚੀਜ਼ ਨੂੰ ਉਤਸਾਹਿਤ ਕਰਨਾ ਚਾਹੀਦਾ ਕਿ ਪੇੜ ਲਗਾਓ ਘਰ ਦੇ ਬਾਹਰ ਆਪਣੀ ਕਿਆਰੀਆਂ ਬਣਾਓ ਜਿੰਨੀ ਹਰਿਆਲੀ ਉੰਨੀ ਜ਼ਿਆਦਾ ਫਾਇਦੇਮੰਦ ਇੱਕ ਬਿਮਾਰੀ ਘੱਟ ਲੱਗੂਗੀ ਸ਼ਹਿਰ 'ਚ ਔਰ ਇੱਕ ਦੇਖ ਕੇ ਵੀ ਤੁਹਾਨੂੰ ਆਪਣੇ ਆਪ ਹੀ ਜ਼ਿਆਦਾ ਲਗੂਗਾ ਕਿ ਮੈਂ ਕਿੰਨਾ ਜ਼ਿਆਦਾ ਸੋਹਣੀ ਕਿਆਰੀ ਬਣਾਈ ਹੈ ਔਰ ਮੈਨੂੰ ਤਾਂ ਵੈਸੇ ਵੀ ਬਹੁਤ ਸ਼ੌਂਕ ਹੈ ਫੁੱਲਾਂ ਦਾ ਪੌਦਿਆਂ ਦਾ ਕਿ ਮੈਂ ਅਲੱਗ ਅਲੱਗ ਤਰ੍ਹਾਂ ਦੇ ਫੁੱਲ ਲਗਾਵਾਂ ਕਿ ਮੈਨੂੰ ਵੀ ਕੋਈ ਲੋਕ ਕਹਿਣ ਕਿ ਹਏ ਨਵੀਨ ਤੇਰੇ ਕਿੱਦਾਂ ਘਰ ਵਿੱਚ ਘਰ ਦੇ ਬਾਹਰ ਇੰਨੀ ਸੋਹਣੀ ਕਿਆਰੀ ਕਿੱਦਾਂ ਬਣਾਈ ਹੈ ਕੀਹਨੂੰ ਦੇਖ ਕੇ ਬਣਾਈ ਕੁਛ ਮੇਰਾ ਇੱਕ ਦੋਸਤ ਹੈਗਾ ਜਿਹਣੇ ਆਈ ਟੀ ਉਹ ਐਗਰਿਕਲਚਰ ਦੀ ਥੋੜ੍ਹੀ ਬਹੁਤੀ ਪੜ੍ਹਾਈ ਕੀਤੀ ਹੋਈ ਹੈ ਉਹ ਵੀ ਮੈਨੂੰ ਆਣ ਕੇ ਦੱਸ ਦਿੰਦਾ ਕਿ ਆਹ ਖਾਦ ਪਾ ਆਹ ਚੀਜ਼ ਪਾ ਇਹਦੇ ਨਾ ਜ਼ਿਆਦਾ ਫਾਇਦਾ ਹੋਏਗਾ ਮੈਂ ਕਾਫੀ ਕੁਝ ਉਹ ਤੋਂ ਵੀ ਸਿੱਖਣ ਨੂੰ ਮਿਲਿਆ ਔਰ ਪ੍ਰੇਰਨਾ ਤਾਂ ਇਹ ਹੀ ਮਿਲਦੀ ਹੈ ਜਿੰਨਾ ਤੁਸੀਂ ਆਪਣਾ ਇਹਨਾਂ ਨੂੰ ਦੇਖੋਗੇ ਇਹਨਾਂ ਦਾ ਖਿਆਲ ਇਹਨਾਂ ਦਾ ਖਿਆਲ ਰੱਖੋਗੇ ਔਰ ਇਹ ਆਕਸੀਜਨ ਮਿਲਦੀ ਹੈ ਕਾਫੀ ਕੁਛ ਇਹ ਵੀ ਆਪਣੀ ਤਰ੍ਹਾਂ ਜੀਵ ਜੰਤੁ ਹੈ ਜੇ ਆਪਾਂ ਨੂੰ ਇੱਕ ਇਹਨਾਂ ਨੂੰ ਪੌਦਾ ਸਮਝਾਂਗੇ ਜਾਂ ਪੇੜ ਸਮਝਾਂਗੇ ਤਾਂ ਫਿਰ ਤਾਂ ਕੁਛ ਵੀ ਨਹੀਂ ਇਹਨਾਂ ਪਾਣੀ ਨਾ ਪਾਓ ਤਾਂ ਸੜ ਜੋਗੇ ਇਸ ਕਰਕੇ ਜੇ ਤੁਸੀਂ ਨਹੀਂ ਪਾਣੀ ਪੀਓਗੇ ਤਾਂ ਤੁਹਾਡਾ ਕੀ ਹਾਲ ਹੋਊਗਾ ਉਸ ਕਰਕੇ ਮੈਂ ਤਾ ਇਹ ਹੀ ਕਹੂੰਗਾ ਕਿ ਸਾਰਿਆਂ ਨੂੰ ਘਰ ਦੇ ਬਾਹਰ ਕਿਆਰੀ ਬਣਾਉਣੀ ਚਾਹੀਦੀ ਹੈ ਜ਼ਿਆਦਾ ਤੋਂ ਜ਼ਿਆਦਾ ਪੇੜ ਪੌਦੇ ਲਗਾਉਣੇ ਚਾਹੀਦੇ ਹੈ ਜਿਸ ਕਰਕੇ ਆਪਣੇ ਬਿਮਾਰੀਆਂ ਘ ਬਿਮਾਰੀਆਂ ਘੱਟ ਫੈਲਣ ਆਕਸੀਜਨ ਜ਼ਿਆਦਾ ਮਿਲੇ ਔਰ ਪੋਲਿਊਸ਼ਨ ਦੀ ਘਾਟ ਹੋਵੇ ਮੈਂ ਤਾਂ ਬਸ ਇਹ ਹੀ ਕਹਿਣਾ ਚਾਹੂੰਗਾ